ਜੀ ਮੈਂ ਕਦੀ ਕੋਈ ਯੂ ਐੱਫ ਓ ਨਹੀਂ ਦੇਖਿਆ ਆਪਣੇ ਜੀਵਨ 'ਚ ਨਾ ਮੈ ਪਰ ਹਾਂ ਮੈਂ ਇਸ ਪਰਿਆਸ 'ਚ ਲੱਗੀ ਰਹਿੰਦੀ ਹਾਂ ਕਿ ਮੈਨੂੰ ਕਦੀ ਕੋਈ ਯੂ ਐੱਫ ਓ ਦਿੱਖ ਜਾਏ ਕਿਉਂਕਿ ਮੇਰੀ ਇਸ ਵਿਸ਼ੇ ਬਾਰੇ ਬਹੁਤ ਰੂਚੀ ਹੈ ਕਿ ਮੈਂ ਕੋਈ ਯੂ ਐੱਫ ਓ ਦੇਖਾਂ ਕੋਈ ਉਡਣ ਖਟੋਲਾ ਜਿਹਨੂੰ ਕਿ ਕਹਿੰਦੇ ਮੈ ਉਹਨੂੰ ਦੇਖਾਂ ਕਿੱਦਾਂ ਦਾ ਹੋਏਗਾ ਉਹ ਮੈਨੂੰ ਇਸ ਬਾਰੇ ਬਹੁਤ ਰੁਚੀ ਹੈ ਇਸ ਕਾਰਨ ਮੈਂ ਆਪਣੇ ਆਪ ਉਸ ਪਰਿਆਸ 'ਚ ਲੱਗੀ ਰਹਿੰਦੀ ਹਾਂ ਕਿ ਜਦੋਂ ਕਦੀ ਆਸਮਾਨ ਵੱਲ ਨਜ਼ਰ ਪਏ ਤਾਂ ਕਦੀ ਕੁਝ ਦਿਖ ਜਾਵੇ ਅਤੇ ਮੈਂ ਇਸ ਵਾ ਕਾਰਨ ਇਹਦੀ ਕਾਫੀ ਯੂਟਿਊਬ 'ਤੇ ਵੀ ਇਸ ਬਾਰੇ ਪੜ੍ਹਦੀ ਰਹਿੰਦੀ ਹਾਂ ਖ਼ਬਰਾਂ 'ਚ ਕਦੀ ਮੈਂ ਆਪਣੇ ਜੀਵਨ 'ਚ ਨਹੀਂ ਦੇਖਿਆ ਪਰ ਜ਼ਰੂਰ ਇਹਦੇ ਬਾਰੇ ਸੁਣਿਆ ਹੈ ਕਿ ਹੁੰਦੇ ਨੇ ਜ਼ਰੂਰ ਹੁੰਦੇ ਨੇ ਅਤੇ ਹੋਰ ਗ੍ਰਹਿਆਂ 'ਤੇ ਜੀਵਨ ਬਾਰੇ ਮੇਰੀ ਇਹ ਵਿਚਾਰ ਨੇ ਕਿ ਬਿਲਕੁਲ ਹੋਰ ਗ੍ਰਹਿਆਂ 'ਤੇ ਜੀਵਨ ਜ਼ਰੂਰ ਹੈ ਸਿਰਫ ਇੱਕ ਧਰਤੀ ਹੀ ਅਜਿਹਾ ਐਸਾ ਗ੍ਰਹਿ ਨੀ ਹੈ ਜਿੱਥੇ ਜੀਵਨ ਹੈ ਮੇਰੇ ਨਜ਼ਰਾਂ ਚ ਹੋਰ ਵੀ ਇਹੋ ਜਿਹਾ ਕੋਈ ਗ੍ਰਹਿ ਜ਼ਰੂਰ ਹੈ ਜਿੱਥੇ ਨਜ਼ਰਾਂ ਜਿੱਥੇ ਕਿ ਇਨਸਾਨੀ ਜੀਵਨ ਸ਼ਾਇਦ ਹੋਏਗਾ ਜੇ ਇਨਸਾਨੀ ਨਹੀਂ ਤਾਂ ਕੋਈ ਹੋਰ ਜੀਵਨ ਤਾਂ ਹੋਏਗਾ ਹੀ ਸਿਰਫ਼ ਇਨਸਾਨ ਹੀ ਨਹੀਂ ਹੋਰ ਵੀ ਪ੍ਰਾਣੀ ਇਸ ਐਗਜਿਸਟ ਕਰਦੇ ਨੇ ਜਿਨ੍ਹਾਂ ਦਾ ਹਜੇ ਸ਼ਾਇਦ ਸਾਨੂੰ ਨਹੀਂ ਪਤਾ ਪਰ ਜੇਕਰ ਪਤਾ ਚੱਲੇ ਤਾਂ ਮੈਨੂੰ ਉਸ ਬਾਰੇ ਬਹੁਤ ਰੂਚੀ ਹੈ ਮੈਂ ਜ਼ਰੂਰ ਜਾਨਣਾ ਚਾਹਵਾਂਗੀ